ਸਤਿ ਸ਼੍ਰੀ ਅਕਾਲ ਵੀਰ ਜੀ ਵੀਰ ਜੀ ਮੈਂ ਤੁਹਾਡੇ ਬਿਲਕੁਲ ਹੀ ਗੁਆਂਢ ਰਹਿੰਦੀ ਹਾਂ ਛੇ ਸੌ ਚੌਵੀ ਨੰਬਰ 'ਚ ਨਿਊ ਅੰਮ੍ਰਿਤਸਰ ਅਤੇ ਅਸੀਂ ਇੱਕ ਫੰਕਸ਼ਨ ਵਿੱਚ ਮਿਲੇ ਵੀ ਸੀ ਯਾਦ ਹੋਣਾ ਤੁਹਾਨੂੰ ਹਾਂ ਮੈਂ ਨਵੀਂ ਨਵੀਂ ਇੱਥੇ ਆਈ ਹਾਂ ਅਤੇ ਮੈਂ ਪੰਜਾਬ ਦੇ ਕੁਝ ਵੱਡੇ ਵੱਡੇ ਸ਼ਹਿਰਾਂ ਬਾਰੇ ਜਾਨਣਾ ਚਾਹੁੰਦੀ ਹਾਂ ਅਤੇ ਅੰਮ੍ਰਿਤਸਰ ਬਾਰੇ ਥੋੜ੍ਹਾ ਬਹੁਤਾ ਪਤਾ ਇੱਥੇ ਗੋਲਡਨ ਟੈਂਪਲ ਹੈ ਅਤੇ ਮੈਨੂੰ ਕੁਝ ਹੋਰ ਵੀ ਦੱਸੋ ਤੁਸੀਂ ਹਾਂ ਘੁੰਮਣਾ ਵੀ ਚਾਹੁੰਦੀ ਹਾਂ ਕੁਝ ਸ਼ੋਪਿੰਗ ਵੀ ਕਰਨੀ ਚਾਹੁੰਦੀ ਹਾਂ

ਕੋਈ ਗੱਲ ਨਹੀਂ ਠੀਕ ਹੈ ਜੀ

ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਜੀ ਜੀ ਮੈਂ ਫਰੀ ਹਾਂ ਬਿਲਕੁਲ ਬੇਸ਼ੱਕ ਕੱਲ੍ਹ ਦਾ ਦਿਨ ਛੱਡ ਕੇ ਪਰਸੋਂ ਤੋਂ ਕਰ ਲਉ ਸ਼ੁਰੂ ਜੇ ਤੁਸੀਂ ਮੇਰੀ ਹੈਲਪ ਕਰੋ ਤਾਂ ਬਹੁਤ ਮਿਹਰਬਾਨੀ ਹੋਏਗੀ

ਹਾਂ ਇੱਥੇ ਬਹੁਤ ਵਧੀਆ ਹੋਏਗਾ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ